ਟੈਕਨੋਲਜੀ ਨੇ ਕਲਾ ਉਦਯੋਗ ਅਤੇ ਕਲਾਕਾਰਾਂ ਦੀ ਕਾਫੀ ਤਰੀਕੇ ਨਾਲ ਮਦਦ ਕੀਤੀ ਹੈ ਜਿਵੇਂ ਕਿ ਅਸ ਇੱਕ ਉਦਾਹਰਨ ਵਜੋਂ ਅਸੀਂ ਸੋਸ਼ਲ ਮੀਡੀਆ ਦੇਖ ਸਕਦੇ ਹਾਂ ਇਸ ਉੱਤੇ ਕੋਈ ਵੀ ਵਿਅਕਤੀ ਜਿਸ ਦੇ ਕੋਲ ਇੰਟਰਨੈੱਟ ਦੀ ਦੀ ਸਹੂਲਤ ਹੋਵੇ ਉਹ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰ ਸਕਦਾ ਹੈ ਅਤੇ ਆਪਣੀ ਕੰਪਨੀ ਜਾਂ ਉਦਯੋਗ ਦੇ ਨੂੰ ਦੇ ਬਾਰੇ ਵੀ ਦੱਸ ਸਕਦਾ ਹੈ ਜਿਸ ਦੇ ਨਾਲ ਉਹਨਾਂ ਦੀ ਕਾਫੀ ਚੰਗੀ ਮਸ਼ਹੂਰੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਕਾਫੀ ਸੋਸ਼ਲ ਮੀਡੀਆ ਉੱਤੇ ਐਪਸ ਉੱਤੇ ਆਪਣੇ ਆਪਣੀ ਵੀਡੀਓ ਜਾਂ ਰੀਲਜ਼ ਪਾਉਣ ਦੇ ਲੋਕਾਂ ਨੂੰ ਪੈਸੇ ਵੀ ਮਿਲਦੇ ਹਨ ਜਿਵੇਂ ਕਿ ਸਪੋਂਸਰਸ਼ਿਪ ਹੋ ਗਈ ਇਸ ਤੋਂ ਇਲਾਵਾ ਇਹ ਇਸ ਤਰੀਕੇ ਨਾਲ ਲੋਕ ਇੱਕ ਹੀ ਜਗ੍ਹਾ 'ਤੇ ਬੈਠ ਕੇ ਆਪਣਾ ਸਾਰਾ ਕੰਮ ਕਰ ਸਕਦੇ ਹਨ ਜਿਸ ਨਾਲ ਸਮਾਂ ਬਚਦਾ ਹੈ ਅਤੇ ਮਸ਼ਹੂਰੀ ਕਾਫੀ ਵਡ ਕਾਫੀ ਸਾਰੇ ਲੋਕਾਂ ਕੋਲੋਂ ਉਹਨਾਂ ਦੀ ਜਾਣਕਾਰੀ ਵੀ ਪਹੁੰਚ ਜਾਂਦੀ ਹੈ ਉਹਨਾਂ ਨੂੰ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਇਸ ਤਰ੍ਹਾਂ ਟੈਕਨੋਲਜੀ ਨੇ ਕਲਾ ਅਤੇ ਉਦਯੋਗ ਨੂੰ ਕਾਫੀ ਮਦਦ ਕੀਤੀ ਹੈ ਇਸ ਤੋਂ ਇਲਾਵਾ ਕਾਫੀ ਸਾਰੇ ਤਰੀਕਿਆਂ ਕਾਫੀ ਸਾਰੀ ਇਸ ਤਰ੍ਹਾਂ ਦੀ ਟੈਕਨੋਲਜੀ ਵੀ ਹੈ ਜਿਹੜੇ ਇਹਨਾਂ ਨੂੰ ਆਪਣੇ ਕੰਮ ਸੁਧਾਰਨ ਵਿੱਚ ਮਦਦ ਕਰਦੀ ਜਿਵੇਂ ਜੇ ਅਸੀਂ ਪੇਂਟਿੰਗ ਦੀ ਗੱਲ ਕਰੀਏ ਤਾਂ ਉਸ ਵਿੱਚ ਅੱਜ ਕੱਲ੍ਹ ਕਾਫੀ ਸਾਰੇ ਇਹੋ ਜਿਹੇ ਟੂਲ ਆ ਗਏ ਹਨ ਜਿਹੜੇ ਜਿਹਨਾਂ ਵਿੱਚ ਟੈਕਨੋਲਜੀ ਦੀ ਵਰਤੋਂ ਨਾਲ ਨਵੇਂ ਨਵੇਂ ਢੰਗਾਂ ਨਾਲ ਚਿੱਤਰ ਬਣਾਏ ਜਾਂਦੇ ਹਨ ਇਹ ਸਭ ਨੇ ਕਲਾਕਾਰਾਂ ਦੀ ਕਾਫੀ ਮਦਦ ਕੀਤੀ ਹੈ ਧੰਨਵਾਦ